ਮੈਨੂੰ ਘੁੰਮਦਾ ਫਿਰਨਾ ਬਹੁਤ ਪਸੰਦ ਆ ਅਤੇ ਮੈਂ ਆਪਣੀ ਲਾਈਫ ਦੇ ਵਿੱਚ ਕਾਫ਼ੀ ਥਾਵਾਂ 'ਤੇ ਟਰਿਪ ਲਗਾਏ ਹੋਏ ਨੇ ਕਾਫ਼ੀ ਥਾਵਾਂ 'ਤੇ ਮੈਂ ਘੁੰਮਿਆ ਹੈਗਾ ਅਤੇ ਮੈਨੂੰ ਸੈਰ ਸਪਾਟੇ ਦਾ ਘੁੰਮਣ ਫਿਰਨ ਦਾ ਬਹੁਤ ਜ਼ਿਆਦਾ ਸ਼ੌਂਕ ਹੈਗਾ ਅਤੇ ਮੈਂ ਲਾਸਟ ਟਾਈਮ ਡਲਹੋਜੀ ਗਿਆ ਸੀ ਘੁੰਮਣ ਅਤੇ ਉੱਥੇ ਟਰੈਕਿੰਗ ਕੀਤੀ ਅਤੇ ਉੱਥੇ ਜਦੋਂ ਮੈਂ ਗਿਆ ਸੀ ਜਿਹੜੇ ਮਹੀਨੇ 'ਚ ਉਦੋਂ ਬਰਫ਼ ਵੀ ਹੈਗੀ ਸੀ ਕਾਫ਼ੀ ਅਤੇ ਉਥੋਂ ਦਾ ਜਿਹੜਾ ਮੌਸਮ ਹੈਗਾ ਬਹੁਤ ਹੀ ਵਧੀਆ ਮੌਸਮ ਹੈਗਾ ਅਤੇ ਉੱਥੇ ਕਾਫ਼ੀ ਥਾਵਾਂ ਨੇ ਘੁੰਮਣ ਵਾਲੀਆਂ ਅਤੇ ਉੱਥੇ ਜਾ ਕੇ ਮੈਨੂੰ ਬਹੁਤ ਜ਼ਿਆਦਾ ਸਕੂਨ ਵੀ ਮਿਲਦਾ ਅਤੇ ਮੇਰੇ ਫਰੈਂਡ ਹੁੰਦੇ ਨੇ ਜ਼ਿਆਦਾਤਰ ਮੇਰੇ ਨਾਲ ਜੋ ਮੇਰੇ ਕਾਲਜ ਦੇ ਦੋਸਤ ਨੇ ਜਦੋਂ ਅਸੀਂ ਫਰੀ ਹੁੰਦੇ ਹੈਗੇ ਅਤੇ ਅਸੀਂ ਆਪਣਾ ਇੱਕ ਟਰਿਪ ਹੈਗਾ ਉਹ ਤਿਆਰ ਕਰਕੇ ਵਧੀਆ ਪਲੈਨਿੰਗ ਕਰਕੇ ਜਾਂਦੇ ਹੈਗੇ ਅਤੇ ਜਦੋਂ ਵੀ ਸਾਡਾ ਮਨ ਕਰਦਾ ਜਦੋਂ ਅਸੀਂ ਥੋੜ੍ਹਾ ਜਿਹਾ ਸਾਨੂੰ ਇੱਦਾਂ ਫੀਲ ਹੁੰਦਾ ਗਾ ਵੀ ਜਾਂ ਅਤੇ ਕੰਮ ਕਾਰ ਤੋਂ ਜ਼ਿਆਦਾ ਸਾਨੂੰ ਬੋਰੀਅਤ ਮਹਿਸੂਸ ਹੋਣ ਲੱਗ ਜਾਂਦੀ ਹੈਗੀ ਤਾਂ ਉਦੋਂ ਹੀ ਅਸੀਂ ਆਪਣਾ ਚਾਰ ਪੰਜ ਮੇਰੇ ਵਧੀਆ ਜੋ ਨਜ਼ਦੀਕੀ ਦੋਸਤ ਨੇ ਉਹਨਾਂ ਨਾਲ ਮਿਲ ਕੇ ਮੈਂ ਪਲੈਨ ਬਣਾਉਂਦਾ ਗਾ ਅਤੇ ਅਸੀਂ ਕਿਤੇ ਨਾ ਕਿਤੇ ਪਹਾੜੀ ਏਰੀਆ ਜਾਂ ਮਤਲਬ ਜੋ ਵੀ ਨੇੜੇ ਸਾਨੂੰ ਪੈਂਦਾ ਹੈਗਾ ਉੱਥੇ ਅਸੀਂ ਘੁੰਮਣ ਜਾਂਦੇ ਹਾਂ ਅਤੇ ਮੌਸਮ ਦਾ ਆਨੰਦ ਮਾਣਦੇ ਹਾਂ